ਹੈਲੋ ਹਾਂਜੀ ਸਰ ਸਵਿਗੀ ਤੋਂ ਗੱਲ ਕਰ ਰਹੇ ਆ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਰ ਆਪਣਾ ਔਡਰ ਸੀਗਾ ਜੀ ਪੰਦਰ੍ਹਾਂ ਕੁ ਮਿੰਟ ਪਹਿਲਾਂ ਆਪਾਂ ਔਡਰ ਕੀਤਾ ਸੀ ਤੁਹਾਨੂੰ ਹਾਂਜੀ ਪੀਜ਼ਾ ਕੋਲਡ ਡਰਿੰਕ ਸੀ ਬਰਗਰ ਸੀ ਆਪਣਾ ਅਤੇ ਖੁਸ਼ਪਿੰਦਰ ਸਿੰਘ ਨਾਂ 'ਤੇ ਔਡਰ ਸੀਗਾ ਜੀ ਬਠਿੰਡਾ ਹਾਂਜੀ ਬਠਿੰਡਾ ਤੋਂ ਭਾਅ ਜੀ ਆਪਾਂ ਔਡਰ ਨਾ ਜੀ ਰਿਪਲੇਸ ਕਰਨਾ ਅਤੇ ਔਡਰ ਨੂੰ ਆਪਾਂ ਥੋੜ੍ਹਾ ਜਿਹਾ ਵਧਾਉਣਾ ਐਕਸਟੈਂਡ ਕਰਨਾ ਜੀ ਹਾਂਜੀ ਹਾਂਜੀ ਹਾਂਜੀ ਆਪਣੇ ਹੁਣ ਦੁਬਾਰਾ ਆਈਟਮਸ ਲਿਖੋ ਜੀ ਪੀਜਾ ਪੀਜਾ ਡਬਲ ਕਰ ਦਿਓ ਜੀ ਚਿਕਨ ਫੁੱਲ ਬਰਗਰ ਜੀ ਸਮੋਸਾ ਅਤੇ ਐਗ ਰੋਲ ਕਰ ਦਿਓ ਜੀ ਅਤੇ ਕੋਲਡ ਡਰਿੰਕ ਅਤੇ ਆਪਾਂ ਪਹਿਲਾਂ ਇੱਕ ਪਿਸ ਮੰਗਵਾਇਆ ਸੀ ਹੁਣ ਦੋ ਬੋਤਲ ਕਰ ਦਿਓ ਜੀ ਹਾਂਜੀ ਪੇਮੈਂਟ ਤੁਹਾਨੂੰ ਔਨਲਾਈਨ ਕਰ ਦਵਾਂਗੇ ਜੀ ਅਤੇ ਆਪਣਾ ਐਡਰੈਸ ਲਿਖੋ ਜੀ ਆਪਣਾ ਐਡਰੈਸ ਲਿਖੋ ਨੋਟ ਕਰੋ ਜੀ ਮਾਡਲ ਟਾਊਨ ਫਰੋਮ ਬਠਿੰਡਾ ਹਾਂਜੀ ਅਤੇ ਆਪਣਾ ਫੋਨ ਨੰਬਰ ਹੈ ਜੀ ਅਠੱਤਰ ਅੱਠ ਬਾਨਵੇਂ ਅਠਾਈ ਜ਼ੀਰੋ ਅਠਾਰ੍ਹਾਂ ਅਤੇ ਛੇ ਸੌ ਸਤਾਸੀ ਨੰਬਰ ਹਾਊਸ ਜੀ ਕਦੋਂ ਕ ਤੱਕ ਭਾਅ ਜੀ ਓਕੇ